ਜਦੋਂ ਅਸੀਂ ਵੱਡੇ ਵੱਡੇ ਸ਼ਹਿਰਾਂ ਵਿੱਚ ਜਾਂਦੇ ਹਾਂ ਉੱਥੇ ਸਾਨੂੰ ਬੱਸਾਂ ਕਾਰਾਂ ਘੱਟ ਟੈਕਸੀ ਜਾਂ ਉਬਰ ਜਾਂ ਓਲਾ ਵਰਗੀਆਂ ਚੀਜ਼ਾਂ ਮਿਲਦੀਆਂ ਹਨ ਜੇਕਰ ਅਸੀਂ ਕਿਸੇ ਵੀ ਵੱਡੀ ਚੰਦੀ ਜਿਵੇਂ ਕਿ ਚੰਡੀਗੜ੍ਹ ਰਾਜਸਥਾਨ ਬਠਿੰਡਾ ਜੇਕਰ ਅਸੀਂ ਇਹਨਾਂ ਸ਼ਹਿਰਾਂ ਵਿੱਚ ਜਾਂਦੇ ਹਾਂ ਤਾਂ ਸਾਨੂੰ ਉਬਰ ਜਾਂ ਓਲਾ ਵਰਗੀਆਂ ਹੀ ਮਿਲਦੀਆਂ ਨੇ ਤਾਂ ਅਸੀਂ ਜੇਕਰ ਮੈਂ ਤੁਹਾਨੂੰ ਇੰਸੀਡੇੰਟ ਸ਼ੇਅਰ ਕਰਨ ਜਾ ਰਿਹਾ ਹਾਂ ਆਪਣਾ ਹੀ ਮੈਂ ਜੋ ਆਪਣੇ ਦੋਸਤ ਕੋਲੋਂ ਲਿੱਤਾ ਫੀਡਬੈਕ ਅਬਾਊਟ ਓਲਾ